ਹਾਂਜੀ ਪਿਛਲੇ ਦਿਨੀ ਪੰਦਰਾਂ ਅਗਸਤ 'ਤੇ ਮੈਂ ਇੱਕ ਡਰਾਇੰਗ ਬਣਾਈ ਸੀ ਜਿਸ ਦੇ ਵਿੱਚ ਮੈਂ ਤਿਰੰਗੇ ਝੰਡੇ ਦੇ ਨਾਲ ਇੰਦਰਾ ਗਾਂਧੀ ਦਾ ਪੋਸਟਰ ਬਣਾਇਆ ਸੀ ਅਤੇ ਮੇਰਾ ਮੇਰੀ ਉਹ ਡਰਾਇੰਗ ਸਭ ਨੂੰ ਬਹੁਤ ਪਸੰਦ ਆਈ ਸੀ ਅਤੇ ਸਭ ਨੇ ਮੇਰੀ ਬਹੁਤ ਪ੍ਰਸ਼ੰਸਾ ਕੀਤੀ ਸੀ ਪਰ ਕਈ ਇਹੋ ਜਿਹੇ ਵੀ ਸੀ ਜਿਨ੍ਹਾਂ ਨੇ ਮੇਰੀਆਂ ਕਮੀਆਂ ਵੀ ਦੱਸੀਆਂ ਸਨ ਅਤੇ ਮੈਂ ਸਾਰਿਆਂ ਦੀ ਪ੍ਰਸ਼ੰਸਾ ਅਤੇ ਕਮੀਆਂ ਨੂੰ ਆਪਣੇ ਦਿਮਾਗ ਵਿੱਚ ਰੱਖ ਲਿਆ ਸੀ ਤਾਂ ਕਿ ਜਦੋਂ ਵੀ ਮੈਂ ਅੱਗੇ ਤੋਂ ਡਰਾਇੰਗ ਬਣਾਵਾਂ ਤਾਂ ਮੈਂ ਉਹਨਾਂ ਕਮੀਆਂ ਨੂੰ ਯਾਦ ਕਰਕੇ ਆਪਣੀਆਂ ਕਮੀਆਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰ ਸਕਾਂ ਅਤੇ ਉਹਨਾਂ ਨੂੰ ਵਧੀਆ ਕਰ ਸਕਾਂ ਕਿਉਂਕਿ ਕਈ ਸਾਰੇ ਲੋਕ ਹੁੰਦੇ ਹਨ ਜਿਹੜੇ ਸਿਰਫ਼ ਪ੍ਰਸ਼ੰਸਾ ਹੀ ਕਰਦੇ ਹਨ ਪਰ ਕੋਈ ਇਹੋ ਜਿਹਾ ਵੀ ਹੋਣਾ ਚਾਹੀਦਾ ਹੈ ਜਿਹੜਾ ਸਾਨੂੰ ਸਾਡੀਆਂ ਕਮੀਆਂ ਦੱਸ ਸਕੇ ਤਾਂ ਕਿ ਅਸੀਂ ਉਹਨਾਂ ਕਮੀਆਂ ਨੂੰ ਸਹੀ ਕਰਕੇ ਆਪਣੀ ਚੀਜ਼ ਨੂੰ ਵਧੀਆ ਬਣਾ ਸਕੀਏ ਅਤੇ ਜਦੋਂ ਮੈਂ ਅਗਲੀ ਡਰਾਇੰਗ ਬਣਾਈ ਅਤੇ ਮੈਂ ਉਹਨਾਂ ਨ ਕਮੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਉਹਨਾਂ ਕਮੀਆਂ ਨੂੰ ਪੂਰੀ ਕਰਨ ਦੀ ਕੋਸ਼ਿਸ਼ ਕੀਤੀ ਅਤੇ ਉਸ ਨਾਲ ਮੇਰੀ ਅਗਲੀ ਡਰਾਇੰਗ ਹੋਰ ਵੀ ਜ਼ਿਆਦਾ ਵਧੀਆ ਬਣ ਗਈ